ਹੈਲੋ ਸਤਿ ਸ਼੍ਰੀ ਅਕਾਲ ਵੀਰੇ ਕਾਫ਼ੀ ਦਿਨ ਬਾਅਦ ਯਾਦ ਕੀਤਾ ਹੋਰ ਦੱਸ ਕੀ ਸੇਵਾ ਸੀ ਅੱਛਾ ਅੱਛਾ ਤੂੰ ਫਿਰੋਜ਼ਪੁਰ ਆਇਆ ਹੋਇਆ ਦੱਸਿਆ ਤਾਂ ਹੈ ਨਹੀਂ ਤੂੰ ਅੱਛਾ ਤਾਂ ਹੁਣ ਫਿਰ ਇੱਥੇ ਹੀ ਰਿਹਾ ਕਰਨਾ ਤੂੰ ਤੇ ਹੁਣ ਤੂੰ ਕਿੱਥੇ ਰਹਿ ਰਿਹਾ ਹੁਣ ਹੋਟਲ 'ਚ ਰੂਮ ਵਗੈਰਾ ਲਿਆ ਹੋਇਆ ਤੂੰ ਅੱਛਾ ਯਾਰ ਤੈਨੂੰ ਪਤਾ ਨਿੰਮ ਵਾਲਾ ਚੌਂਕ ਕਿਹੜਾ ਹੈਗਾ ਫਿਰੋਜ਼ਪੁਰ ਦਾ ਉਹ ਹੀ ਜਿੱਥੇ ਮਤਲਬ ਕਾਫ਼ੀ ਬਾਜ਼ਾਰ ਵਿੱਚ ਇਹ ਹੈਗਾ ਉਹ ਅਤੇ ਉੱਥੇ ਨਾ ਤਿੰਨ ਹਜ਼ਾਰ ਰੁਪਏ ਦੇ ਹਿਸਾਬ ਨਾਲ ਤੈਨੂੰ ਇੱਕ ਕਮਰਾ ਮਿਲ ਜਾਣਾ ਠੀਕ ਹੈ ਅਤੇ ਇੱਕ ਰਸੋਈ ਹੋਵੇਗੀ ਅਤੇ ਇੱਕ ਬਾਥਰੂਮ ਵੀ ਇੱਕ ਬੰਦੇ ਦਾ ਵਧੀਆ ਅਰੇਂਜਮੈਂਟ ਹੋ ਜਾਂਦਾ ਉੱਥੇ ਜੇ ਆਪਾਂ ਦੇਖੀਏ ਤਾਂ ਪੀ ਜੀ ਹੈਗਾ ਉੱਥੇ ਸਾਰੇ ਮੁੰਡੇ ਕੁੜੀਆਂ ਮਤਲਬ ਮੁੰਡੇ ਹੀ ਮੁੰਡਿਆਂ ਦਾ ਹੀ ਹੈ ਹੋ ਤਾਂ ਖੈਰ ਉੱਥੇ ਤੁਹਾਨੂੰ ਕੋਈ ਪਰੇਸ਼ਾਨੀ ਵੀ ਨਹੀਂ ਹੋਵੇਗੀ ਨਾਲੇ ਬਾਜ਼ਾਰ ਵਿੱਚ ਹੈਗਾ ਸੇਫ ਹੈ ਜਗ੍ਹਾ ਪੂਰੀ ਹਾਂ ਨਹੀਂ ਜਗ੍ਹਾ ਤਾਂ ਰੋਣਕ ਵਾਲੀ ਹੈਗੀ ਹੈ ਮੈਂ ਤੈਨੂੰ ਉਹਦੇ ਫੋਟੋ ਵਿੱਚ ਸੈਂਡ ਕਰ ਦੇਵਾਂਗੀ ਜਿਵੇਂ ਬਣਿਆ ਹੋਇਆ ਹੈਗਾ ਪੋਰਸ਼ਨ ਉਹ ਅਤੇ ਉਹਦਾ ਮਾਨ ਮਕਾਨ ਮਾਲਕ ਦਾ ਤੈਨੂੰ ਨੰਬਰ ਵੀ ਸੈਂਡ ਕਰ ਦੂੰਗੀ ਹੋਰ ਦੱਸ ਕੋਈ ਸੇਵਾ ਯਾਰ ਉਹ ਤੈਨੂੰ ਪਤਾ ਨਾ ਅਜ਼ਾਦ ਚੌਂਕ ਜਿਹੜਾ ਆਪਣਾ ਫਿਰੋਜ਼ਪੁਰ ਦਾ ਇੱਥੇ ਹੀ ਹੈਗਾ ਤੈਨੂੰ ਕੋਈ ਵੀ ਦੱਸ ਦੂਗਾ ਜਦੋਂ ਤੂੰ ਜਾਵੇਂਗਾ ਤਾਂ ਅਜ਼ਾਦ ਚੌਂਕ ਦੇ ਨਾ ਥੋੜ੍ਹਾ ਅੱਗੇ ਜਾ ਕੇ ਸਬਜ਼ੀ ਮੰਡੀ ਹੈ ਵੱਡੀ ਵਾਲੀ ਉੱਥੋਂ ਹਾਂ ਜਦੋਂ ਮਤਲਬ ਕਾਫ਼ੀ ਵੱਡੀ ਹੈ ਸਬਜ਼ੀ ਮੰਡੀ ਉਹ ਅਤੇ ਉੱਥੇ ਫਰੂਟ ਵਗੈਰਾ ਤੈਨੂੰ ਹਰ ਤਰ੍ਹਾਂ ਦੀ ਸਬਜ਼ੀ ਹੈ ਨਾ ਤਾਜ਼ੀ ਮਿਲ ਜਾਂਦੀ ਰੋਜ਼ ਭਾਵੇਂ ਤੂੰ ਲੈ ਆਇਆ ਕਰੀਂ ਓਫ਼ਿਸ 'ਚੋਂ ਆਉਂਦੀ ਵਾਰ ਤਾਜ਼ੀ ਸਬਜ਼ੀਆਂ ਮਿਲ ਜਾਣਗੀਆਂ ਅਤੇ ਉੱਥੇ ਦੁੱਧ ਦੀ ਡੇਰੀ ਵੀ ਸਾਹਮਣੇ ਹੈਗੀ ਆ ਪਨੀਰ ਦੁੱਧ ਤਾਜ਼ਾ ਹੀ ਮਿਲਦਾ ਵਧੀਆ ਹੀ ਆ ਸਮਾਨ ਸਾਰਾ ਅਸੀਂ ਵੀ ਉੱਥੋਂ ਹੀ ਲੈਂਦੇ ਹਾਂ ਹਾਂ ਨਹੀਂ ਤਾਜ਼ਾ ਖਾਣਾ ਤਾਂ ਵੈਸੇ ਵੀ ਸਿਹਤ ਵਾਸਤੇ ਵੀ ਬਹੁਤ ਵਧੀਆ ਹੀ ਰਹਿੰਦਾ ਹਰ ਇੱਕ ਬੰਦੇ ਨੂੰ ਇਹ ਹੀ ਖਾਣਾ ਹੀ ਚਾਹੀਦਾ ਹੈ ਨਾ ਵੀ ਮਜ਼ਬੂਰੀ ਬੰਦੇ ਨੇ ਇੱਕ ਰੋਟੀ ਤਾਂ ਖਾਣੀ ਆ ਉਹ ਵੀ ਬੰਦਾ ਸਹੀ ਨਾ ਖਾਵੇ ਤਾਂ ਫ਼ਾਇਦਾ ਹੀ ਕੀ ਫਿਰ ਹੋਰ ਅੱਛਾ ਖਾਲਸਾ ਗੁਰਦੁਆਰਾ ਯਾਰ ਉਹ ਜਿਹੜਾ ਆਪਾਂ ਬਚਪਨ ਤੇ ਜਿਹੜਾ ਪ ਪੜ੍ਹੇ ਨਹੀਂ ਸੀਗੇ ਸਕੂਲ 'ਚ ਵੀ ਐੱਨ ਐੱਮ ਸਕੂਲ ਹੈ ਨਾ ਉਹ ਉਹ ਹੀ ਸਿੱਧੀ ਸੜਕ ਜਾਂਦੀ ਥੋੜ੍ਹਾ ਜਿਹਾ ਅੱਗੇ ਮੈਡੀਕਲ ਦੇ ਸਾਹਮਣੇ ਹੀ ਹੈ ਬਿਲਕੁਲ ਖਾਲਸਾ ਗੁਰਦੁਆਰਾ ਬੜੇ ਇੱਥੇ ਬਾਹਰ ਬਾਰ ਬਾਹਰੋਂ ਹੀ ਬੰਦੇ ਆਉਂਦੇ ਨੇ ਇੱਥੇ ਮੱਥਾ ਟੇਕਣ ਵਾਸਤੇ ਮੈਂ ਵੀ ਸਵੇਰੇ ਰੋਜ਼ ਹੀ ਜਾਂਦੀ ਹਾਂ ਸਵੇਰੇ ਤੜਕੇ ਤਾਂ ਤੂੰ ਮੇਰੇ ਨਾਲ ਹੀ ਚੱਲ ਪਿਆ ਕਰੀਂ ਆਪਾਂ ਇਕੱਠੇ ਹੋਏ ਆਵਾਂ ਕਰਾਂਗੇ ਗੁਰੂ ਘਰ ਮੱਥਾ ਟੇਕਣ ਠੀਕ ਹੈ ਹਾਂ ਅਤੇ ਹੋਰ ਪੜ੍ਹਾਈ ਪੜੁਈ ਵੀ ਨਾਲ ਕਰਦਾ ਹੋਣਾ ਤੂੰ ਅੱਛਾ ਫਿਰ ਤਾਂ ਵਧੀਆ ਹੈ ਨਾ ਵੀ ਉਹ ਬੰਦਾ ਆਪਣਾ ਖਰਚਾ ਆਪ ਹੀ ਕੱਢ ਲੈਂਦਾ ਅੱਛਾ ਅਤੇ ਹੁਣ ਤੂੰ ਕਿਹੜਾ ਕੋਰਸ ਕਰਦਾ ਪਿਆ ਅੱਛਾ ਤਾਂ ਬੁਕਸ ਵਗੈਰਾ ਤੈਨੂੰ ਕਾਲਜ ਵਾਲੇ ਦਿੰਦੇ ਨੇ ਕਿ ਤੂੰ ਲੈਣੀਆਂ ਨੇ ਤੂੰ ਅੱਛਾ ਅਤੇ ਪੰਜਾਬ ਬੁੱਕ ਡੀਪੂ ਸੁਣਿਆ ਤੂੰ ਉੱਥੇ ਹੈਗਾ ਅਤੇ ਹਾਂ ਇਹ ਨਿੰਮ ਵਾਲੇ ਚੌਂਕ ਤੇ ਹੀ ਹੈਗਾ ਉਹ ਪੰਜਾਬ ਬੁੱਕ ਡੀਪੂ ਇੱਥੇ ਤੁਹਾਨੂੰ ਸਾਰੀ ਕਿਤਾਬਾਂ ਮਿਲ ਜਾਣਗੀਆਂ ਸੈਕਿੰਡ ਵੀ ਮਿਲ ਜਾਂਦੀ ਇੱਥੇ ਸਸਤੇ ਰੇਟਾਂ 'ਚ ਅਤੇ ਆਪਾਂ ਪੜ੍ਹਨਾ ਹੀ ਹੈ ਨਾ ਵੀ ਆਪਾਂ ਕਿਹੜਾ ਸ਼ੋਕੇਸ਼ 'ਚ ਲਗਾ ਕੇ ਰੱਖਣੀਆਂ ਨੇ ਕਿਤਾਬਾਂ ਹਾਂ ਨਹੀਂ ਸੈਕਿੰਡ ਹੈਂਡ ਵੀ ਤੈਨੂੰ ਵਧੀਆ ਕੁਆਲਿਟੀ ਦੀ ਉੱਥੇ ਮਿਲ ਜਾਣਗੀਆਂ ਵੀ ਹਾਲਤ 'ਚ ਚੰਗੀ ਹੁੰਦੀ ਹੈ ਮੈਂ ਵੀ ਹੁਣ ਉੱਥੇ ਬੀ ਏ ਦੀ ਸਾਰੀ ਆਪਾਂ ਕਿਤਾਬਾਂ ਉੱਥੇ ਹੀ ਲਈਆਂ ਸੀ ਪੰਜਾਬ ਡੀਪੂ ਕੋਲੋਂ ਹੁੰ ਤਾਂ ਗੁਰੂ ਨਾਨਕ ਕਾਲਜ ਰਾਹੀਂ ਕਰਦਾ ਪਿਆ ਨਾ ਤੂੰ ਦੱਸਿਆ ਸੀਗਾ ਚਾਚੀ ਨੇ ਵੀ ਅੱਛਾ ਹਾਂ ਨਹੀਂ ਵਧੀਆ ਗੱਲ ਹੈਗਾ ਬੰਦੇ ਨੂੰ ਪੜ੍ਹਾਈ ਕਿਉਂ ਛੱਡਣੀ ਹੈ ਨਾ ਜੋਬ ਵੀ ਬੰਦਾ ਨਾਲ ਨਾਲ ਹੀ ਕਰਦਾ ਰਹੇ ਤਾਂ ਵਧੀਆ ਚੱਲਦਾ ਰਹਿੰਦਾ ਗੁਜ਼ਾਰਾ ਹੁੰ ਸਹੀ ਹੈ ਫਿਰ ਤਾਂ ਅਤੇ ਸਾਰਾਗੜੀ ਗੁਰਦੁਆਰਾ ਵੀ ਇੱਥੋਂ ਦਾ ਕਾਫ਼ੀ ਫੇਮਸ ਹੀ ਹੈਗਾ ਸਾਰਾਗੜੀ ਗੁਰਦੁਆਰਾ ਹਾਂ ਫਿਰੋਜ਼ਪੁਰ ਦਾ ਸਭ ਤੋਂ ਫੇਮਸ ਹੈਗਾ ਅਤੇ ਹੁਸੈਨੀ ਵਾਲਾ ਬਾਰਡਰ ਆਪਾਂ ਇਸ ਐਤਵਾਰ ਦਾ ਪ੍ਰੋਗਰਾਮ ਬਣਾਵਾਂਗੇ ਆਪਾਂ ਨਾਲ ਦਿਆਂ ਨੂੰ ਵੀ ਲੈ ਚੱਲਾਂਗੇ ਠੀਕ ਹੈ ਹਾਂ ਹਾਂ ਹੋਰ ਸੇਵਾ ਹੋਵੇ ਤਾਂ ਦੱਸੀ ਚੰਗਾ ਹਾਂ ਧੰਨਵਾਦ ਠੀਕ ਹੈ